ਮੇਰੀ ਜੋ ਮਨਪਸੰਦ ਮਾਰਸ਼ਲ ਆਰਟ ਆ ਉਹ ਗੱਤਕਾ ਗੱਤਕਾ ਮਾਰਸ਼ਲ ਆਰਟ ਕਿਉਂ ਮੇਰੀਆਂ ਜਿਹੜੀਆਂ ਮਨਪਸੰਦ ਆ ਇੱਕ ਇਹਦਾ ਤਾਂ ਕਾਰਨ ਆ ਵੀ ਜਿਹੜਾ ਸਿੱਖੀ ਸਰੂਪ ਨਾਲ ਜੁੜੇ ਰਹੀਦਾ ਗਾ ਗੁਰੂ ਸਾਹਿਬਾਨਾਂ ਨਾਲ ਜੁੜੇ ਰਹੀਦਾ ਆਪਣੇ ਕਲਚਰ ਆਪਣੇ ਵਿਰਸੇ ਨਾਲ ਜੁੜੇ ਰਹੀਦਾ ਗਾ ਉਸ ਕਾਰਨ ਕਰਕੇ ਕਿਹੜੀ ਹੈਗੀ ਆ ਮੈਨੂੰ ਇਹ ਮਾਰਸ਼ਲ ਆਰਟ ਬੜੀ ਹੀ ਪਸੰਦ ਆ ਅਤੇ ਇਸ ਮਾਰਸ਼ਲ ਆਰਟ ਕੋਈ ਵੀ ਮਾਰਸ਼ਲ ਆਰਟ ਵੈਸੇ ਸਿੱਖਣੀ ਜ਼ਰੂਰੀ ਆ ਤੁਹਾਨੂੰ ਜੋ ਵੀ ਪਸੰਦ ਹੋਵੇ ਤੁਸੀਂ ਉਹ ਮਾਰਸ਼ਲ ਆਰਟ ਸਿੱਖੋ ਕਿਉਂਕਿ ਸੈਲਫ ਡਿਫੈਂਸ ਦੇ ਪੁਆਇੰਟ ਔਫ ਵਿਊ 'ਤੇ ਜਿਹੜੀ ਮਾਰਸ਼ਲ ਆਰਟ ਆ ਉਹ ਜ਼ਰੂਰੀ ਹੁੰਦੀ ਆ ਗੱਤਕਾ ਸਾਡਾ ਜਿਹੜਾ ਪੰਜਾਬ ਦਾ ਹੈ ਰਵਾਇਤੀ ਜਿਹੜੀ ਹੈ ਮਾਰਸ਼ਲ ਆਰਟ ਹੈ ਮਰਵਾਇਟੀ ਖੇਡ ਦੇ ਵਿੱਚ ਆ ਜਾਂਦੀ ਆ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੀ ਹੋਈ ਖੇਡ ਹੈ ਅਤੇ ਉਹ ਸਿੱਖਣੀ ਇੱਕ ਗੁਰੂ ਸਾਹਿਬਾਨਾਂ ਦੇ ਨਜ਼ਦੀਕ ਹੋਣਾ ਉਸ ਪਰਪਸ 'ਤੇ ਮੈਨੂੰ ਜਿਹੜੀ ਬੜੀ ਪਸੰਦ ਆ ਤਾਂ ਕਰਕੇ ਜਿਹੜੀ ਹੈਗੀ ਆ ਮੈਨੂੰ ਗੱਤਕੇ ਦਾ ਮੈਂ ਖੁਦ ਪਲੇਅਰ ਰਿਹਾ ਮੈਨੂੰ ਚੰਗੀ ਤਰ੍ਹਾਂ ਜਿਹੜੀ ਹੈਗੀ ਆ ਮਾਰਸ਼ਲ ਆਰਟ ਇਹ ਆਉਂਦੀ ਹੈ